ਜਿਵੇਂ ਕਿ ਸਿਹਤ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਕੁਛ ਚੀਜ਼ਾਂ ਹਨ ਜੋ ਕਿ ਨਜ਼ਰ ਅੰਦਾਜ਼ ਕੀਤੀਆਂ ਜਾਂਦੀਆਂ ਹਨ ਜਿਵੇਂ ਕਿ ਹੋਸਪੀਟਲਸ ਅਤੇ ਸਕੂਲਾਂ ਵਿੱਚ ਸਫ਼ਾਈ ਦਾ ਧਿਆਨ ਧਿਆਨ ਨਾ ਰੱਖਣਾ ਜਿਵੇਂ ਕਿ ਸਰਕਾਰ ਤਾਂ ਧਿਆਨ ਰੱਖਦੀ ਹੈ ਪਰ ਕੁਛ ਲੋਕ ਹੁੰਦੇ ਹਨ ਜੋ ਕਿ ਉੱਥੇ ਗੰਦਗੀ ਪਾਉਂਦੇ ਹਨ ਜਿਵੇਂ ਕਿ ਆਬਾਦੀ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਬਹੁਤ ਜ਼ਿਆਦਾ ਵੱਧ ਰਹੀ ਹੈ ਅਤੇ ਇਸ ਨਾਲ ਅ ਗ ਗ਼ਰੀਬੀ ਅਤੇ ਭੁੱਖਮਰੀ ਜ਼ਿਆਦਾ ਹੋ ਰਹੀ ਹੈ ਜਿਵੇਂ ਕਿ ਸਰਕਾਰ ਵੱਲੋਂ ਬਹੁਤ ਸਾਰੇ ਲੋਕਾਂ ਨੂੰ ਰਾਸ਼ਨ ਕਾਰਡ 'ਤੇ ਭੋਜਨ ਵੰਡਿਆ ਜਾਂਦਾ ਹੈ ਪਰ ਕੁਛ ਲੋਕਾਂ ਨੂੰ ਉਹ ਪ੍ਰਾਪਤ ਨਹੀਂ ਹੁੰਦਾ ਹੈ ਅਤੇ ਉਹਨਾਂ ਨੂੰ ਮਹਿੰਗੀਆਂ ਚੀਜ਼ਾਂ ਵੱਲ ਜਾਣਾ ਪੈਂਦਾ ਹੈ ਜਿਹ ਜਿਹਦੇ ਕਰਕੇ ਉਹਨਾਂ ਨੂੰ ਪੌਸ਼ਟਿਕ ਆਹਾਰ ਨਹੀਂ ਮਿਲਦਾ ਹੈ ਇਸ ਤਰ੍ਹਾਂ ਅਨਪੜ੍ਹ ਲੋਕ ਹੁੰਦੇ ਹਨ ਜਿਹੜੇ ਉਹਨਾਂ ਨੂੰ ਆਬਾਦੀ ਵਿੱਚ ਸਹਿਯੋਗ ਦੇਣ ਦਾ ਨਹੀਂ ਪਤਾ ਹੁੰਦਾ ਹੈ ਅਤੇ ਜਿਸ ਕਰਕੇ ਹੁਣ ਆਬਾਦੀ ਵੱਧਦੀ ਜਾ ਰਹੀ ਹੈ ਅਤੇ ਮੈਂ ਸਰਕਾਰ ਨੂੰ ਇਹ ਹੀ ਅਪੀਲ ਕਰਾਂਗੀ ਕਿ ਸਿ ਸਿਹਤ ਖੇਤਰ ਵੱਲ ਜ਼ਿਆਦਾ ਧਿਆਨ ਦਿੱਤਾ ਜਾਵੇ ਤਾਂ ਕਿ ਚਾਹੇ ਉਹ ਪਿੰਡ ਹੋਵੇ ਇਲਾਕਾ ਹੋਵੇ ਚਾਹੇ ਦੇਸ਼ ਹੋਵੇ ਜਿਸ ਨਾਲ ਉਹ ਵਧੀਆ ਚੱਲ ਸਕੇ